ਮੈਂ ਆਪਣੀ ਜ਼ਿੰਦਗੀ ਵਿੱਚ ਟਰੇਨ ਦਾ ਸਫ਼ਰ ਬਹੁਤ ਹੀ ਘੱਟ ਕਰਿਆ ਹੈ ਜਦੋਂ ਮੈਨੇ ਪਹਿਲੀ ਵਾਰ ਆਪਣੀ ਟਰੇਨ ਦਾ ਸਫ਼ਰ ਕੀਤਾ ਸੀ ਤਦ ਬਾਰਾਂ ਸਾਲ ਦੀ ਸੀ ਮੈਂ ਟਰੇਨ ਦਾ ਸਫ਼ਰ ਬਾਰਾਂ ਸਾਲ ਦੀ ਉਮਰ 'ਚ ਕੀਤਾ ਸੀ ਮੈਂ ਪਟਿਆਲੇ ਤੋਂ ਬਠਿੰਡਾ ਜਾਣ ਜਾ ਰਹੀ ਸੀ ਆਪਣੀ ਭੂਆ ਕੋਲ ਅਸੀਂ ਸਾਰੇ ਪਰਿਵਾਰ ਵਾਲੇ ਇੱਕਠੇ ਹੀ ਟਰੇਨ ਦਾ ਸਫਰ ਕਰ ਰਹੇ ਸੀ ਜਦੋਂ ਮੈਂ ਟਰੇਨ ਨੂੰ ਦੇਖਿਆ ਤਾਂ ਮੈਨੂੰ ਬਹੁਤ ਹੀ ਵਧੀਆ ਲੱਗੀ ਉਸਦਾ ਰੰਗ ਬਹੁਤ ਅੱਛਾ ਸੀ ਤਾਂ ਜਦੋਂ ਮੈਂ ਟਰੇਨ ਦੇ ਅੰਦਰ ਗਈ ਤਾਂ ਸੀਟਾਂ ਬਹੁਤ ਹੀ ਵਧੀਆ ਸੀਗੀਆਂ ਅਤੇ ਖਿੜਕੀਆਂ ਬਹੁਤ ਹੀ ਵਧੀਆ ਲਗਾਈਆਂ ਹੋਈਆਂ ਸੀ ਸ਼ੀਸ਼ੇ ਵਾਲੀਆਂ ਅਤੇ ਇੱਥੇ ਬਾਥਰੂਮ ਦੀ ਫਸਿਲਟੀ ਕਾਫੀ ਵਧੀਆ ਸੀ ਅਤੇ ਟਰੇਨ ਦੇ ਬਾਹਰ ਕਾਫੀ ਖਾਣ ਪੀਣ ਦਾ ਵੀ ਸਮਾਨ ਸੀ ਅਤੇ ਉਹ ਉਸ ਦ ਦੁਕਾਨ ਦੇ ਖਾਣ ਪੀਣ ਦੀ ਦੁਕਾਨ ਦੇ ਜਿਹੜੇ ਜਿਹੜੇ ਵੇਚਦੇ ਨੇ ਸਮਾਨ ਉਹ ਟਰੇਨ ਅੰਦਰ ਵੀ ਆਉਂਦੇ ਸੀ ਅਤੇ ਅ ਸਮਾਨ ਵੇਚਦੇ ਸੀਗੇ ਅਤੇ ਆਪਣੀ ਕਮਾਈ ਕਰਦੇ ਸੀ ਅਤੇ ਮੈਨ ਬਹੁਤ ਹੀ ਮੈਨੇ ਇਹ ਸਫ਼ਰ ਨੂੰ ਇੰਨਜੋਏ ਕੀਤਾ ਇਹ ਤਿੰਨ ਘੰਟਿਆਂ ਦਾ ਸਫ਼ਰ ਸੀਗਾ ਅਤੇ ਮੈਨੇ ਬਹੁਤ ਹੀ ਅਨੰਦ ਮਾਣਿਆ ਧੰਨਵਾਦ